ਮੇਰੇ ਕੋਲ ਬਹੁਤ ਸਾਰੀਆਂ ਕਿਤਾਬਾਂ ਹਨ ਜਿਹਨਾਂ ਵਿੱਚ ਕਵਿਤਾਵਾਂ ਕਹਾਣੀਆਂ ਜਾਸੂਸੀ ਨਾਵਲ ਇਤਿਹਾਸਕ ਬਹੁਤ ਸਾਰੀਆਂ ਹੀ ਕਿਤਾਬਾਂ ਹਨ ਅਤੇ ਮੈਂ ਸਭ ਤੋਂ ਜ਼ਿਆਦਾ ਇਤਿਹਾਸ ਨੂੰ ਪਸੰਦ ਕਰਦਾ ਹਾਂ ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਾਬਾ ਦੀਪ ਸਿੰਘ ਸ਼ਹੀਦ ਊਧਮ ਸਿੰਘ ਅਤੇ ਭਗਤ ਸਰਦਾਰ ਭਗਤ ਸਿੰਘ ਇਹਨਾਂ ਦੀਆਂ ਬਹੁਤ ਜ਼ਿਆਦਾ ਹੀ ਕਹਾਣੀਆਂ ਮੈਂ ਪੜ੍ਹੀਆਂ ਹਨ ਅਤੇ ਇਹਨਾਂ ਦੇ ਉੱਪਰ ਇਹਨਾਂ ਦਾ ਮੇਰੇ ਉੱਪਰ ਬਹੁਤ ਪ੍ਰਭਾਵ ਹੁੰਦਾ ਹੈ ਬਹੁਤ ਅਸਰ ਹੁੰਦਾ ਹੈ ਮੈਂ ਚਾਹੁੰਦਾ ਹਾਂ ਕਿ ਹੋਰ ਅੱਜ ਦੀ ਜੋ ਲੋਕ ਹੈ ਲੋਕ ਹਨ ਉਹ ਵੀ ਇਹਨਾਂ ਕਿਤਾਬਾਂ ਬਾਰੇ ਪੜ੍ਹਨ ਅਤੇ ਆਪਣਾ ਜੀਵਨ ਪੱਧਰ ਉੱਚਾ ਬਣਾਉਣ